ਅੱਜ ਕੱਲ੍ਹ ਦੇ ਸਮਿਆਂ ਵਿੱਚ ਜ਼ਿਆਦਾਤਰ ਲੋਕ ਟੁੱਟੀਆਂ ਹੀ ਵਰਤਦੇ ਆ ਪਰ ਪੁਰਾਣੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜ਼ਿਆਦਾਤਰ ਹੈਂਡ ਪੰਪ ਹੀ ਯੂਸ ਹੁੰਦਾ ਸੀਗਾ ਕਿਉਂਕਿ ਉਹਦੇ ਵਿੱਚ ਪਾਣੀ ਨਿੱਕਲ ਜਾਂਦਾ ਸੀਗਾ ਬਿਨਾਂ ਬਿਜਲੀ ਤੋਂ ਮੈਨੂੰ ਯਾਦ ਆ ਮੈਂ ਅੱਜ ਤੱਕ ਕਦੇ ਹੈਂਡ ਪੰਪ ਨਹੀਂ ਦੇਖਿਆ ਅਤੇ ਮੈਨੂੰ ਯਾਦ ਆ ਮੈਂ ਪਿਛਲੇ ਸਾਲ ਆਪਣੇ ਘਰਦਿਆਂ ਦੇ ਨਾਲ ਹੇਮਕੁੰਟ ਸਾਹਿਬ ਗਿਆ ਸੀਗਾ ਅਤੇ ਰਸਤੇ ਦੇ ਵਿੱਚ ਮੈਂ ਬਹੁਤ ਪਿਆਸਾ ਸੀਗਾ ਅਤੇ ਪਿਆਸੇ ਨੂੰ ਦੇਖ ਕੇ ਮੈਂ ਉੱਥੇ ਰਾਸਤੇ ਦੇ ਵਿੱਚ ਗੱਡੀ ਰੋਕੀ ਅਤੇ ਉੱਥੇ ਇੱਕ ਹੈਂਡ ਪੰਪ ਸੀਗਾ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਆਇਆ ਕੀ ਆ ਉਸ ਤੋਂ ਬਾਅਦ ਮੈਨੂੰ ਮੇਰੇ ਘਰਦਿਆਂ ਨੇ ਦੱਸਿਆ ਹੈਂਡ ਪੰਪ ਆ ਇਹਦੇ 'ਚ ਪਾਣੀ ਨਿਕਲਦਾ ਏ ਅਤੇ ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਿਆ ਅਤੇ ਉਹ ਤੋਂ ਮੈਂ ਨਲਕਾ ਗੇੜਨਾ ਸਟਾਰਟ ਕਰਤਾ ਸ਼ੁਰੂ ਸ਼ੁਰੂ ਦੇ ਵਿੱਚ ਖਾਲੀ ਨਲਕੇ ਵਿੱਚ ਕੁਛ ਨਹੀਂ ਆਇਆ ਜਦੋਂ ਮੈਂ ਤਿੰਨ ਚਾਰ ਪੰਪ ਮਾਰੇ ਫਿਰ ਉਹਦੇ ਵਿੱਚ ਇੱਕਦਮ ਪਾਣੀ ਆਇਆ ਅਤੇ ਪਾਣੀ ਪੂਰਾ ਸਾਫ਼ ਸੀਗਾ ਅਤੇ ਬਹੁਤ ਖੁਸ਼ ਹੋਇਆ ਅਤੇ ਮੈਂ ਚਾਅ ਚਾਅ ਦੇ ਵਿੱਚ ਬਹੁਤ ਜ਼ਿਆਦਾ ਨਲਕਾ ਗੇੜਿਆ ਅਤੇ ਉਹਦੇ ਵਿੱਚ ਪਾਣੀ ਵੀ ਪੂਰਾ ਸਾਫ਼ ਆ ਰਿਹਾ ਸੀਗਾ ਪਹਿਲਾਂ ਮੈਂ ਨਲਕੇ ਦਾ ਪਾਣੀ ਪੀ ਕੇ ਦੇਖਿਆ ਪਰ ਨਲਕੇ ਦਾ ਪਾਣੀ ਪੀ ਕੇ ਮੈਂ ਬਹੁਤ ਖੁਸ਼ ਹੋਇਆ ਕਿਉਂਕਿ ਉੱਥੇ ਪਾਣੀ ਦਾ ਕੋਈ ਫਰਕ ਨਹੀਂ ਸੀਗਾ ਟੂਟੀਆਂ ਨਾਲੋਂ ਅਤੇ ਉਸ ਤੋਂ ਬਾਅਦ ਜਦੋਂ ਉੱਥੇ ਆਉਂਦੇ ਜਾਂਦੇ ਸਵਾਰੀਆਂ ਬਹੁਤ ਪਿਆਸੀਆਂ ਸੀਗੀਆਂ ਅਤੇ ਮੈਂ ਸਲਾਹ ਬਣਾਈ ਕਿ ਮੈਂ ਕੁਛ ਕੁ ਸਵਾਰੀਆਂ ਨੂੰ ਪਾਣੀ ਪਿਲਾਵਾਂ ਕਿਉਂਕਿ ਪਾਣੀ ਪੀਣਾ ਇੱਕ ਬਹੁਤ ਵਧੀਆ ਪੁੰਨ ਆ ਅਤੇ ਉਹ ਤੋਂ ਬਾਅਦ ਮੈਂ ਨਲਕਾ ਗੇੜਿਆ ਅਤੇ ਉਹ ਨਲਕਾ ਜਮੀਂ ਖੁਸ਼ਕ ਨਹੀਂ ਸੀਗਾ ਕਿਉਂਕਿ ਉਹਦੀ ਪੂਰੀ ਪ੍ਰੋਪਰ ਮੇਨਟੇਨ ਕੀਤੀ ਹੋਈ ਸੀਗੀ ਅਤੇ ਨਲਕਾ ਪੂਰਾ ਚਮਕਦਾ ਫਿਰਦਾ ਸੀਗਾ ਅਤੇ ਉੱਥੇ ਇੱਕ ਨਾ ਨਹੀਂ ਕੋਈ ਰਸਟ ਵੀ ਨਹੀਂ ਸੀਗੀ ਉੱਥੇ ਕਿਉਂਕਿ ਉਹਦੇ ਉੱਪਰ ਪੂਰਾ ਪ੍ਰੋਪਰ ਪੇਂਟ ਕੀਤਾ ਹੋਇਆ ਸੀਗਾ ਅਤੇ ਮੈਂ ਨਾਲਕੇ ਨੂੰ ਗੇੜ ਕੇ ਬਹੁਤ ਖੁਸ਼ ਹੋਇਆ ਅਤੇ ਮੈਨੂੰ ਆ ਇੱਥੋਂ ਤੱਕ ਇਹੀ ਜਾਣ ਕੇ ਵੀ ਬੜੀ ਹੈਰਾਨੀ ਹੋਈ ਕਿ ਪਾਣੀ ਨਲਕੇ 'ਚੋਂ ਬਹੁਤ ਥੱਲੇ ਤੋਂ ਪਾਣੀ ਆਉਂਦਾ ਹੈ